ਜੋ ਵੀ ਬੱਚੇ ਇਹ ਖਾਣਾ ਪਕਾਉਣ ਨੂੰ ਆਪਣਾ ਇੱਕ ਸ਼ੌਂਕ ਮੰਨਦੇ ਹਨ ਜਿਹਨਾਂ ਨੂੰ ਖਾਣਾ ਪਕਾਉਣਾ ਬਹੁਤ ਪਸੰਦ ਹੈ ਜਾਂ ਮੁੰਡੇ ਹਨ ਜਾਂ ਕੁੜੀਆਂ ਹਨ ਉਹਨਾਂ ਨੂੰ ਇਸ ਆਪਣੀ ਸ਼ੌਂਕ ਦੀ ਪੂਰਤੀ ਕਰਨ ਲਈ ਅੱਜ ਕੱਲ੍ਹ ਖਾਣਾ ਪਕਾਉਣ ਸਕੂਲ ਬਹੁਤ ਖੁੱਲ੍ਹ ਗਏ ਹਨ ਜਿਨ੍ਹਾਂ ਵਿੱਚ ਉਹਨਾਂ ਦੀ ਇਹ ਸ਼ੌਕ ਦੀ ਪੂਰਤੀ ਲਈ ਉਹਨਾਂ ਨੂੰ ਵੱਖਰੇ ਵੱਖਰੇ ਅਦਾਰਿਆਂ ਵਿੱਚ ਐਡਮਿਸ਼ਨ ਦਿੱਤੀ ਜਾਂਦੀ ਹੈ ਅਤੇ ਉਹਦੇ ਵਿੱਚ ਉਹਨਾਂ ਦੇ ਇਸ ਸ਼ੌਂਕ ਨੂੰ ਪੂਰਾ ਕੀਤਾ ਜਾਂਦਾ ਹੈ ਕਈ ਲੋਕ ਤਾਂ ਇਸ ਨੂੰ ਇੱਕ ਪੇਸ਼ੇ ਦੇ ਤੌਰ 'ਤੇ ਹੀ ਲੈਣ ਲੱਗ ਪਏ ਹਨ ਜਿਨ੍ਹਾਂ ਦੀ ਜ਼ਿਆਦਾ ਡਿਮਾਂਡ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਇਸ ਸ਼ੌਂਕ ਦੀ ਪੂਰਤੀ ਲਈ ਇਹਨਾਂ ਖਾਣਾ ਪਕਾਉਣ ਸਕੂਲਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਖਾਣੇ ਸਿਖਾਏ ਜਾਂਦੇ ਹਨ ਜਿਵੇਂ ਇਟੈਲੀਅਨ ਅਮੈਰੀਕਨ ਚਾਈਨੀਜ਼ ਹਰ ਤਰ੍ਹਾਂ ਦੇ ਖਾਣੇ ਇਹਨਾਂ ਨੂੰ ਇੱਥੇ ਸਿਖਾਏ ਜਾਂਦੇ ਹਨ ਅਤੇ ਉਹ ਭਵਿੱਖ ਉਹਨਾਂ ਦਾ ਇਹਦੇ ਕਰਕੇ ਬਹੁਤ ਹੀ ਵਧੀਆ ਬਣ ਜਾਂਦਾ ਹੈ ਇਹਨਾਂ ਨੂੰ ਵੱਖਰੇ ਵੱਖਰੇ ਦੇਸ਼ਾਂ ਤੋਂ ਵੱਖਰੇ ਵੱਖਰੇ ਸ਼ਹਿਰਾਂ ਤੋਂ ਇਹਨਾਂ ਦੀ ਦੇਖਦਿਆਂ ਹੋਇਆਂ ਕਾਬਲੀਅਤ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਉੱਥੇ ਨੌਕਰੀਆਂ ਮਿਲਦੀਆਂ ਹਨ ਜਿਨ੍ਹਾਂ ਨਾਲ ਇਹ ਆਪਣੇ ਇੱਕ ਤਾਂ ਆਪਣੇ ਸ਼ੌਕ ਦੀ ਪੂਰਤੀ ਕਰਦੇ ਹਨ ਇੱਕ ਇਹਨੂੰ ਪੇਸ਼ੇ ਦੇ ਤੌਰ 'ਤੇ ਲੈ ਕੇ ਅੱਛੀਆਂ ਤਨਖਾਹਾਂ ਵੀ ਲੈਂਦੇ ਹਨ ਜਿਹਨਾਂ ਕਰਕੇ ਇਹਨਾਂ ਦੇ ਆਪਣੇ ਸੁਪਨੇ ਪੂਰੇ ਹੁੰਦੇ ਹਨ ਇਹ ਬਹੁਤ ਵਧੀਆ ਇੱਕ ਅਦਾਰਿਆਂ ਦਾ ਕੰਮ ਬਹੁਤ ਵਧੀਆ ਚੱਲ ਪਿਆ ਸਰਕਾਰ ਨੇ ਬੜਾ ਸੋਹਣਾ ਸ਼ੁਰੂ ਕਰ ਦਿੱਤਾ ਹੈ ਕਿ ਜਿਨ੍ਹਾਂ ਜਿਨ੍ਹਾਂ ਬੱਚਿਆਂ ਦੀ ਇਹ ਸ਼ੌਂਕ ਦੀ ਪੂਰਤੀ ਹੈ ਕਿ ਅਸੀਂ ਇੱਕ ਚੰਗੇ ਸ਼ੈੱਫ ਬਣੀਏ ਚੰਗਾ ਖਾਣਾ ਪਕਾਈਏ ਪਰ ਸਿਰਫ਼ ਇਹਦੇ ਵਿੱਚ ਇੱਕ ਇਹ ਪ੍ਰੋਬਲਮ ਆਉਂਦੀ ਹੈ ਕਿ ਜਿਹੜੇ ਮਾਸਾਹਾਰੀ ਹਨ ਉਹਨਾਂ ਲਈ ਤਾਂ ਠੀਕ ਹੈ ਜਿਹੜੇ ਸ਼ਾਕਾਹਾਰੀ ਹਨ ਉਹਨਾਂ ਨੂੰ ਵੀ ਇਹ ਕੰਮ ਸਿੱਖਣ ਲਈ ਹਰ ਚੀਜ਼ ਹੀ ਕਰਨੀ ਪੈਂਦੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਜਿਹੜੇ ਸ਼ਾਕਾਹਾਰੀ ਹਨ ਉਹ ਸਿਰਫ਼ ਵੈੱਜ ਖਾਣਾ ਹੀ ਬਣਾਉਣਗੇ ਇਹਨਾਂ ਨੂੰ ਹਰ ਤਰ੍ਹਾਂ ਦਾ ਖਾਣਾ ਬਣਾਉਣਾ ਪੈਂਦਾ ਹੈ ਤਾਂ ਹੀ ਇਹਨਾਂ ਨੂੰ ਇੱਕ ਚੰਗੀ ਜਗ੍ਹਾ 'ਤੇ ਚੰਗੀ ਨੌਕਰੀ ਮਿਲਦੀ ਹੈ ਅਤੇ ਇਹ ਆਪਣੇ ਸ਼ੌਂਕ ਦੀ ਪੂਰਤੀ ਕਰ ਪਾਉਂਦੇ ਹਨ